ਅੱਜ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਨੂੰ ਇੱਕ ਨਾ ਇੱਕ ਸ਼ੌਂਕ ਹੁੰਦਾ ਹੈ ਜਿਵੇਂ ਕਿ ਕਈਆਂ ਨੂੰ ਖਾਣ ਪੀਣ ਦਾ ਸ਼ੌਂਕ ਘੁੰਮਣ ਫਿਰਨ ਦਾ ਸ਼ੌਂਕ ਖੇਡਣ ਦਾ ਸ਼ੌਂਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਅਤੇ ਗਾਉਣ ਦਾ ਸ਼ੌਂਕ ਵੀ ਹੁੰਦਾ ਹੈ ਮੈਨੂੰ ਵੀ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ ਜੋ ਕਿ ਮੈਂ ਬਚਪਨ ਤੋਂ ਹੀ ਕਰਦੀ ਆ ਰਹੀ ਹਾਂ ਅਤੇ ਸਿੱਖਦੀ ਵੀ ਹਾਂ ਮੈਂ ਇਹ ਡਾਂਸ ਓਨਲਾਈਨ ਜਿਵੇਂ ਕਿ ਯੂਟੀਊਬ ਅਤੇ ਹੋਰ ਵੀ ਬਹੁਤ ਸਾਰੇ ਐਪ ਤੋਂ ਸਿੱਖਿਆ ਹੈ ਜਿਵੇਂ ਕਿ ਯੂਟੀਊਬ 'ਤੇ ਬਹੁਤ ਸਾਰੇ ਲੋਕ ਡਾਂਸ ਸਿਖਾਉਂਦੇ ਹਨ ਜਿਵੇਂ ਕਿ ਮੈਂ ਉੱਥੋਂ ਡਾਂਸ ਸਿੱਖਿਆ ਅਤੇ ਰੋਜ਼ ਇੱਕ ਦੋ ਘੰਟੇ ਡਾਂਸ ਕਰਦੀ ਹਾਂ ਅਤੇ ਨਾਲ ਹੀ ਆਪਣੀਆਂ ਕੋਚਿੰਗ ਕਲਾਸਿਸ ਵੀ ਲਗਾਉਂਦੀ ਹਾਂ ਮੈਨੂੰ ਡਾਂਸ ਜ਼ਿਆਦਾ ਯੂਟੀਊਬ ਤੋਂ ਸਿੱਖਿਆ ਅਤੇ ਬਹੁਤ ਹੀ ਵਧੀਆ ਹੁਣ ਆ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਹੋਰ ਵੀ ਐਪ ਜਿਵੇਂ ਕਿ ਇੰਸਟਾਗਰਾਮ ਆਦਿ 'ਤੇ ਵੀ ਡਾਂਸ ਸਿਖਾਇਆ ਜਾਂਦਾ ਹੈ ਉੱਥੇ ਵੀ ਦੋ ਤਿੰਨ ਲੋਕ ਆਦਿ ਹੋਰ ਡਾਂਸ ਸਿਖਾਉਂਦੇ ਹਨ ਜੋ ਕਿ ਮੈਂ ਸਿੱਖਿਆ ਅਤੇ ਨਾਲ ਹੀ ਮੈਂ ਕੋਰੀਓਗ੍ਰਾਫੀ ਬਣਾਉਣੀ ਵੀ ਸਿੱਖੀ ਅਤੇ ਹੁਣ ਮੈਂ ਇੰਸਟਾਗਰਾਮ 'ਤੇ ਆਪਣੀ ਕੋਰੀਓਗ੍ਰਾਫੀ ਵੀ ਬਣਾਈ ਹੋਈ ਹੈ ਅਤੇ ਮੈਨੂੰ ਡਾਂਸ ਦਾ ਵੀ ਬਹੁਤ ਸ਼ੌਂਕ ਸੀ ਜੋ ਕਿ ਮੈਂ ਇੰਸਟਾਗਰਾਮ ਜਾਂ ਯੂਟੀਊਬ ਆਦਿ ਹੋਰ ਵੀ ਬਹੁਤ ਸਾਰੇ ਐਪਾਂ ਤੋਂ ਸਿੱਖਿਆ ਅਤੇ ਬਹੁਤ ਹੀ ਵਧੀਆ ਕਰਦੀ ਹਾਂ ਹੁਣ ਮੈਂ ਡਾਂਸ ਵੀ ਬਹੁਤ ਵਧੀਆ ਸਿੱਖ ਚੁਕੀ ਹਾਂ ਅਤੇ ਕਰਦੀ ਹਾਂ ਮੈਨੂੰ ਡਾਂਸ ਕਰਨ ਨਾਲ ਕਰਨ ਦਾ ਬਚਪਨ ਤੋਂ ਹੀ ਬਹੁਤ ਸ਼ੌਂਕ ਸੀ